ਮੇਰੇ ਮਨ ਪਸੰਦ ਸਾਹਿਤਿਕ ਪਾਤਰ ਭਗਤ ਕਬੀਰ ਜੀ ਹਨ ਉਹ ਮੈਨੂੰ ਇਸ ਕਰਕੇ ਵਧੀਆ ਲੱਗਦੇ ਹਨ ਕਿਉਂਕਿ ਉਹ ਹਰ ਵੇਲੇ ਪਰਮਾਤਮਾ ਨੂੰ ਪਾਉਣ ਦੀ ਗੱਲ ਹੀ ਕਰਦੇ ਹਨ ਅਤੇ ਮੈਨੂੰ ਉਹਨਾਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਿਆ ਕਿ ਪਰਮਾਤਮਾ ਨੂੰ ਮਿਲਣਾ ਕਿਵੇਂ ਹੈ ਭਗਤੀ ਕਿਵੇਂ ਕਰਨੀ ਹੈ ਅਤੇ ਇੱਕ ਵਾਰ ਦੀ ਘਟਨਾ ਹੈ ਕਿ ਉਹਨਾਂ ਨੂੰ ਪਿੰਡ ਵਿੱਚ ਕੋਈ ਮਿਲਣ ਲਈ ਆਇਆ ਅਤੇ ਉਹਨੇ ਭਗਤ ਕਬੀਰ ਜੀ ਬਾਰੇ ਪੁੱਛਿਆ ਵੀ ਉਹ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਅਤੇ ਉਹ ਕਿੱਥੇ ਮਿਲਣਗੇ ਤਾਂ ਉਦੋਂ ਪਿੰਡ ਦੇ ਲੋਕਾਂ ਨੇ ਕਿਹਾ ਕਿ ਉਹ ਤਾਂ ਤੈਨੂੰ ਸ਼ਮਸ਼ਾਨ ਘਾਟ ਵਿੱਚ ਹੀ ਮਿਲਣਗੇ ਤੂੰ ਉੱਥੇ ਚਲਾ ਜਾ ਪਰ ਜਦੋਂ ਮੈਂ ਉੱਥੇ ਗਿਆ ਅਤੇ ਉਹਨਾਂ ਨੇ ਇਹ ਵੀ ਨਿਸ਼ਾਨੀ ਦੱਸੀ ਕਿ ਉਹਨਾਂ ਦੇ ਸਿਰ 'ਤੇ ਉੱਪਰ ਕਲਗੀ ਲੱਗੀ ਹੋਵੇਗੀ ਪਰ ਜਦੋਂ ਮੈਂ ਸ਼ਮਸ਼ਾਨ ਘਾਟ ਗਿਆ ਤਾਂ ਉੱਥੇ ਦੇਖਿਆ ਕਿ ਸਭ ਦੇ ਹੀ ਕਲਗੀ ਲੱਗੀ ਹੋਈ ਹੈ ਪਰ ਮੈਨੂੰ ਮੁਸ਼ਕਿਲ ਆਈ ਵੀ ਹੁਣ ਮੈਨੂੰ ਪਹਿਚਾਣ ਕਿਵੇਂ ਹੋਵੇ ਤਾਂ ਮੈਂ ਸੋਚਿਆ ਵੀ